ਅੱਜ ਸੈਰ ਸਪਾਟਾ ਆਪਣੀਆਂ ਵੱਖਰੀਆਂ ਅਤੇ ਵਿਲੱਖਣ ਵਿਸ਼ੇਸ਼ਤਾਵਾਂ ਦੇ ਨਾਲ ਵਿਸ਼ਵ ਆਰਥਿਕਤਾ ਵਿੱਚ ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਲਾਭਕਾਰੀ ਉਦਯੋਗਾਂ ਵਿੱਚੋਂ ਇੱਕ ਬਣ ਗਿਆ ਹੈ ਅਤੇ ਭੂਗੋਲਿਕ ਸਥਾਨਾਂ ਵਿੱਚ ਤਬਦੀਲੀਆਂ ਲਈ ਇੱਕ ਪਲੇਟਫੋਰਮ ਪ੍ਰਦਾਨ ਕੀਤਾ ਹੈ ਇਹ ਅਧਿਐਨ ਰਵਾਇਤੀ ਬਸਤੀਆਂ ਦੇ ਆਰਥਿਕ ਵਿਕਾਸ ਅਤੇ ਧਾਰਮਿਕ ਸੈਰ ਸਪਾਟੇ ਦੇ ਪ੍ਰਭਾਵਾਂ ਦੀ ਜਾਂਚ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ ਖੋਜ ਵਿਧੀ ਵਿਆਖਕ ਅਤੇ ਵਿਸ਼ਲੇਸ਼ਨਕ ਹੈ ਅੰਤਰਨ ਵੇਰੀਏਬਲ ਧਾਰਮਿਕ ਸੈਰ ਸਪਾਟਾ ਹੈ ਜਿਸ ਨੂੰ ਦਸ ਹਿੱਸਿਆਂ ਦੁਆਰਾ ਮਾਪਿਆ ਜਾਂਦਾ ਹੈ ਅਤੇ ਨਿਰਭਰ ਵੇਰੀਏਬਲ ਸੈਰ ਸਪਾਟਾ ਖੇਤਰਾਂ ਵਿੱਚ ਆਮਦਾਨੀ ਅਤੇ ਰੁਜ਼ਗਾਰ ਹਨ ਜਿਨ੍ਹਾਂ ਦਾ ਕ੍ਰਮਵਾਰ ਰੂਸ ਵਿੱਚ ਦਸ ਹਿੱਸਿਆਂ ਨਾਲ ਅਧਿਐਨ ਕੀਤਾ ਜਾਂਦਾ ਹੈ ਡੇਟਾ ਵਿਸ਼ਲੇਸ਼ਨ ਐੱਸ ਪੀ ਐੱਸ ਐੱਸ ਸੋਫਟਵੇਅਰ ਵਿੱਚ ਕੀਤਾ ਗਿਆ ਸੀ ਫਿਰ ਇੱਕ ਪੀਅਰਸਨ ਦੇ ਸਿਹਤ ਸੰਬੰਧਤ ਟੈਸਟ ਵੈਸੇ ਤਾਂ ਸਧਾਰਨ ਪ੍ਰੀਖਿਅਕ ਦੀ ਵਰਤੋਂ ਕੀਤੀ ਗਈ ਸੀ ਇਸ ਤੋਂ ਇਲਾਵਾ ਅਸਲ ਵਿੱਚ ਧਾਰਮਿਕ ਅਤੇ ਪਰੰਪਰਾਗਤ ਰੀਤੀ ਰਿਵਾਜ਼ਾਂ ਵਾਲੇ ਖੇਤਰਾਂ ਵਿੱਚ ਧਾਰਮਿਕ ਸੈਰ ਸਪਾਟੇ ਦੇ ਵਿਕਾਸ ਦਾ ਰੁਜ਼ਗਾਰ ਪੈਦਾ ਕਰਨ ਆਮਦਨ ਵਿੱਚ ਵਾਧਾ ਅਤੇ ਆਰਥਿਕ ਖੁਸ਼ਹਾਲੀ ਵਿੱਚ ਪ੍ਰਭਾਵ ਪਿਆ ਹੈ ਆਮ ਤੌਰ 'ਤੇ ਧਾਰਮਿਕ ਸੈਰ ਸਪਾਟਾ ਅਤੇ ਵਿਸ਼ੇਸ਼ਤਾਵਾਂ ਦੇ ਨਾਲ ਇਸ ਵਿਸ਼ੇਸ਼ ਅਧਿਕਾਰ ਨਾਲ ਖੇਤਰਾਂ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਮਹੱਤਵਪੂਰਨ ਕਾਰਕ ਮੰਨਿਆ ਜਾਂਦਾ ਹੈ ਯੋਗਦਾਨ ਵਿੱਚ ਲੇਖ ਨੇ ਰੂਸ ਵਿੱਚ ਆਰਥਿਕਤਾ ਅਤੇ ਸੈਰ ਸਪਾਟਾ ਉਦਯੋਗ ਉੱਤੇ ਧਾਰਮਿਕ ਸੈਰ ਸਪਾਟੇ ਦੀ ਮਜ਼ਬੂਤ ਭੂਮਿਕਾ ਨੂੰ ਸਾਬਿਤ ਕੀਤਾ ਹੈ ਵਿਸ਼ੇਸ਼ ਵਿਸ਼ਲੇਸ਼ਣ ਜੋ ਕਿ ਸੱਭਿਆਚਾਰਕ ਅਤੇ ਸੈਰ ਸਪਾਟਾ ਨੀਤੀ 'ਤੇ ਧਿਆਨ ਦੇ ਹੱਕਦਾਰ ਇਸ ਤੋਂ ਇਲਾਵਾ ਇਸ ਨੇ ਖੋਜ ਨਤੀਜਿਆਂ ਨੂੰ ਹੋਰ ਦੁਬਾਰਾ ਵਿਚਾਰਿਆ ਹੈ ਦੇਸ਼ ਭਰ ਵਿੱਚ ਲੋਕ ਹਰ ਜਗ੍ਹਾ 'ਤੇ ਸੈਰ ਸਪਾਟਾ ਦੇ ਕਰਨਾ ਅਤੇ ਟਰੈਵਲਿੰਗ ਕਰਨਾ ਪਸੰਦ ਕਰਦੇ ਹਨ